ਜਿਵੇਂ ਕਿ ਦੇਖਿਆ ਜਾ ਸਕਦਾ ਹੈ ਕਿ ਲਾਈਵ ਪੇਂਟਿੰਗ ਦਾ ਦੌਰ ਬਹੁਤ ਵੱਧ ਗਿਆ ਹੈ ਜਗ੍ਹਾ ਜਗ੍ਹਾ 'ਤੇ ਲੋਕ ਬੈਠ ਕੇ ਲੋਕਾਂ ਦੀਆਂ ਲਾਈਵ ਪੇਂਟਿੰਗਾਂ ਬਣਾਉਂਦੇ ਹਨ ਅਤੇ ਮੈਨੂੰ ਵੀ ਇਹਦੇ ਵਿੱਚ ਬਹੁਤ ਦਿਲਚਸਪੀ ਹੈ ਪੇਂਟਿੰਗ ਬਣਾਉਣ ਅਤੇ ਬਣਵਾਉਣ ਦੇ ਵਿੱਚ ਵੀ ਮੈਂ ਬਹੁਤ ਦਿਲਚਸਪੀ ਰੱਖਦੀ ਹਾਂ ਮੈਨੂੰ ਯਾਦ ਹੈ ਆਖਰੀ ਮਹੀਨੇ ਮੈਂ ਆਪਣੇ ਪਿਤਾ ਜੀ ਨਾਲ ਇੱਕ ਲੇਕ ਗਈ ਸੀ ਉੱਥੇ ਲੇਕ ਦੇ ਕਿਨਾਰੇ ਕੁਛ ਬੰਦੇ ਬੈਠੇ ਸਨ ਜਿਹੜੇ ਲਾਈਵ ਪੇਂਟਿੰਗ ਬਣਾਉਂਦੇ ਸੀ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੈਨੂੰ ਇਹਦੇ ਵਿੱਚ ਬਹੁਤ ਦਿਲਚਸਪੀ ਹੈ ਮੈਂ ਉਹਨਾਂ ਸਾਹਮਣੇ ਬੈਠ ਕੇ ਆਪਣੀ ਪੇਂਟਿੰਗ ਬਣਵਾਈ ਅਤੇ ਮੈਂ ਦੇਖਿਆ ਕਿ ਉਹਨਾਂ ਨੇ ਬਹੁਤ ਬਰੀਕੀ ਨਾਲ ਬਹੁਤ ਸੁੰਦਰ ਪੇਂਟਿੰਗ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣਾ ਦਿੱਤੀ ਬਟ ਜਦੋਂ ਮੈਂ ਆਪਣੀ ਪੇਂਟਿੰਗ ਨੂੰ ਆਪਣੀ ਅੱਖਾਂ ਨਾਲ ਵੇਖਿਆ ਤਾਂ ਮੈਂ ਦੇਖਿਆ ਕਿ ਉਹ ਬਹੁਤ ਹੀ ਮੁਸ਼ਕਿਲ ਸੀ ਬਣਾਊਣੀ ਜਿਵੇਂ ਕਿ ਮੇਰੇ ਪਿਛਲਾ ਜੋ ਵੀ ਮੇਰਾ ਵਿਊ ਸੀਗਾ ਸਾਰਾ ਕੁਛ ਬਹੁਤ ਹੀ ਔਖਾ ਸੀ ਬਣਾਉਣਾ ਬਟ ਉਹਨਾਂ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੇਰੀ ਪੇਂਟਿੰਗ ਨੂੰ ਮੇਰੇ ਸਾਹਮਣੇ ਪੇਸ਼ ਕੀਤਾ ਅਤੇ ਮੈਂ ਇਸ ਚੀਜ਼ ਨੂੰ ਬਣਾਉਣ ਦੇ ਵਿੱਚ ਵੀ ਬਹੁਤ ਦਿਲਚਸਪੀ ਰੱਖਦੀ ਹਾਂ ਮੈਂ ਆਪਣੇ ਘਰ ਦੇ ਵਿੱਚ ਆਪਣੇ ਘਰਦਿਆਂ ਦੇ ਕੁਛ ਕੁਛ ਚਰਿੱਤਰ ਆਪਣੇ ਡਰਾਇੰਗ ਦੇ ਵਿੱਚ ਬਣਾ ਕੇ ਰੱਖਦੀ ਹਾਂ